ਸਤਿ ਸ਼੍ਰੀ ਅਕਾਲ ਮੈਂ ਸ਼ਾਲਿਨੀ ਮਹਿਤਾ ਜਗਜੀਤ ਸਿਨਮਾ ਵਿੱਚ ਟਾਈਗਰ ਜਿੰਦਾ ਹੈ ਦੀ ਸਕਰੀਨਿੰਗ ਲਈ ਪੰਦਰ੍ਹਾਂ ਫੈਬਰਰੀ ਨੂੰ ਸ਼ਾਮ ਦੇ ਸੱਤ ਵਜੇ ਕੀਤੀ ਗਈ ਆਪਣੇ ਗਰੁੱਪ ਬੁਕਿੰਗ ਰੱਦ ਕਰਨ ਲਈ ਮੁਆਫੀ ਮੰਗਦੀ ਹਾਂ ਸਾਡੀ ਬੁਕਿੰਗ ਸ਼ਾਲਿਨੀ ਮਹਿਤਾ ਦੇ ਨਾਂ 'ਤੇ ਵੀ ਲੋਕਾਂ ਲਈ ਕੀਤੀ ਗਈ ਸੀ ਜਿਸ ਦਾ ਰੈਫਰੈਂਸ ਨੰਬਰ ਐਚ ਟੀ ਐਫ ਬੀ ਐਫ ਜੀ ਤਿੰਨ ਛੇ ਇੱਕ ਡਬਲਿਊ ਹੈ ਅਤੇ ਟਰੇਸ ਨੰਬਰ ਸੱਤ ਅੱਠ ਦੋ ਸੱਤ ਛੇ ਸੱਤ ਸੱਤ ਚਾਰ ਸੱਤ ਹਨ ਅਫਸੋਸ ਦੀ ਗੱਲ ਹੈ ਕਿ ਸਾਡੇ ਕੰਪਨੀ ਵਿੱਚ ਅਚਾਨਕ ਸਿਸਟਮ ਬੰਦ ਪੈ ਗਿਆ ਹੈ ਜਿਹਦੇ ਕਰਕੇ ਕਾਫ਼ੀ ਹਫੜਾ ਦਫੜੀ ਮਚੀ ਹੋਈ ਹੈ ਜਿਸ ਕਰਕੇ ਸਾਡੇ ਤੋਂ ਬੁਕਿੰਗ ਰੱਦ ਕਰਨ ਦੇ ਇਲਾਵਾ ਹੋਰ ਕੋਈ ਵਿਕਲਪ ਨਹੀਂ ਹੈ ਮੈਂ ਸਮਝਦੀ ਹਾਂ ਕਿ ਬੁਕਿੰਗ ਰੱਦ ਕਰਨਾ ਤੁਹਾਡੇ ਲਈ ਬਹੁਤ ਨੁਕਸਾਨਦਾਇਕ ਹੋ ਸਕਦਾ ਹੈ ਅਤੇ ਇਸ ਅਸੁਵਿਧਾ ਲਈ ਮੈਂ ਸੱਚ ਮੁੱਚ ਮੁਆਫੀ ਮੰਗਦੀ ਹਾਂ ਮੈਂ ਅਤੇ ਮੇਰਾ ਗਰੁੱਪ ਇਸ ਫਿਲਮ ਨੂੰ ਦੇਖਣ ਲਈ ਬਹੁਤ ਉਤਸਾਹਿਤ ਸਨ ਬੇਨਤੀ ਹੈ ਕਿ ਮੈਨੂੰ ਥਿਏਟਰ ਦੀ ਰੱਦ ਕਰਨ ਦੀ ਪੋਲਿਸੀ ਬਾਰੇ ਦੱਸੋ ਅਤੇ ਅਗਰ ਕੋਈ ਫੀਸ ਦੇਣ ਦੀ ਜ਼ਰੂਰਤ ਹੋਵੇ ਮੈਨੂੰ ਉਸ ਚੀਜ਼ ਬਾਰੇ ਵੀ ਜ਼ਰੂਰ ਦੱਸੋ ਮੈਂ ਬਹੁਤ ਜ਼ਿਆਦਾ ਧੰਨਵਾਦ ਹੋਵਾਂਗੀ ਅਗਰ ਤੁਸੀਂ ਸਾਡੇ ਬੁਕਿੰਗ ਦੀ ਰੱਦ ਕਰਨ ਦੀ ਕਨਫਰਮੇਸ਼ਨ ਮੈਨੂੰ ਮੇਰੇ ਈਮੇਲ ਸ਼ਾਲਿਨੀ ਮਹਿਤਾ ਐਟ ਦਾ ਰੇਟ ਜੀਮੇਲ ਡੋਟ ਕੋਮ 'ਤੇ ਭੇਜ ਸਕੋ ਮੈਂ ਤੁਹਾਡਾ ਧੰਨਵਾਦ ਕਰਾਂਗੀ ਔਰ ਅਤੇ ਇਸ ਆਸੁਵਿਧਾ ਲਈ ਮੈਨੂੰ ਬਹੁਤ ਮੁਆਫੀ ਮੰਗਣ ਦੀ ਲੋੜ ਹੈ